ਸਤਿ ਸ਼੍ਰੀ ਅਕਾਲ ਜੀ ਮੈਨੂੰ ਓਨਲਾਈਨ ਚੀਜ਼ਾਂ ਮੰਗਵਾਉਣੀਆਂ ਸਭ ਤੋਂ ਵਧੀਆ ਲੱਗਦੀਆਂ ਨੇ ਸਭ ਤੋਂ ਪਹਿਲਾਂ ਮੈਂ ਜਿਹੜੀ ਆਪਣੀ ਸ਼ੋਪਿੰਗ ਕੀਤੀ ਸੀ ਉਹ ਮੈਂ ਫਲਿਪਕਾਰਟ ਤੋਂ ਕੀਤੀ ਸੀ ਓਨਲਾਈਨ ਸ਼ੋਪਿੰਗ ਅਤੇ ਮੈਂ ਕੱਪੜਾ ਕੱਪੜਿਆਂ ਦੇ ਵਿੱਚੋਂ ਕੁੜਤੀ ਮੰਗਵਾਈ ਸੀ ਉਹ ਕੁੜਤੀ ਮੈਨੂੰ ਉਹ ਸੱਚੀ ਕਹਾਂ ਤਾਂ ਬਹੁਤ ਪਸੰਦ ਆਈ ਸੀ ਉਹਦਾ ਕੱਪੜਾ ਵੀ ਬਹੁਤ ਵਧੀਆ ਸੀ ਉਹਦਾ ਸਾਈਜ਼ ਵੀ ਬਿਲਕੁਲ ਫਿਟ ਆਇਆ ਸੀ ਮੇਰੇ ਉਹਦਾ ਰੰਗ ਵੀ ਬੜਾ ਸੋਹਣਾ ਸੀ ਅਤੇ ਜਿਹੜਾ ਧੋਣ ਤੋਂ ਬਾਅਦ ਵੀ ਨਹੀਂ ਨਿਕਲਿਆ ਮੈਂ ਬਹੁਤ ਡਰਦੀ ਹੋਈ ਸੀ ਕਿ ਪਤਾ ਨਹੀਂ ਮੈਂ ਮੰਗਵਾ ਰਹੀ ਹਾਂ ਕੱਪੜੇ ਕਿੱਦਾਂ ਦੇ ਹੋਣਗੇ ਕਿੱਦਾਂ ਦਾ ਸਟੱਫ ਹੋਵੇਗਾ ਮੇਰੀ ਮੰਮੀ ਮੈਨੂੰ ਬਹੁਤ ਲੜਦੇ ਸੀ ਕਿ ਤੁਸੀਂ ਓਨਲਾਈਨ ਸ਼ੋਪਿੰਗ ਕਰਨ ਦਾ ਕੀ ਮਤਲਬ ਬਣਦਾ ਹੈ ਕੱਪੜਾ ਤਾਂ ਦੇਖ ਕੇ ਹੀ ਪਤਾ ਲੱਗਦਾ ਹੈ ਪਰ ਮੈਂ ਆਪਣੇ ਰਿਸਕ ਦੇ ਉੱਤੇ ਕੁੜਤੀ ਮੰਗਵਾਈ ਅਤੇ ਉਹ ਕੁੜਤੀ ਸੱਚੀ ਬਹੁਤ ਸੋਹਣੀ ਆਈ ਸੀ ਮੈਂ ਜਦੋਂ ਵੀ ਅੱਜ ਵੀ ਜਦੋਂ ਵੀ ਪਾਉਂਦੀ ਹਾਂ ਉਹ ਕੁੜਤੀ ਤਾਂ ਲੋਕ ਮੇਰੀ ਸੱਚੀ ਬਹੁਤ ਤਾਰੀਫ ਕਰਦੇ ਨੇ ਉਹ ਮੈਨੂੰ ਬਹੁਤ ਘੱਟ ਰੇਟ ਦੇ ਉੱਤੇ ਮਿਲ ਗਈ ਸੀ ਇਹ ਵੀ ਮੇਰੇ ਲਈ ਪਲੱਸ ਪੁਆਈਂਟ ਸੀਗਾ ਅਤੇ ਉਹ ਕੁੜਤੀ ਦਾ ਕੱਪੜਾ ਅਤੇ ਕੁੜਤੀ ਦਾ ਫਿਟਿੰਗ ਡਿਜ਼ਾਇਨ ਸਾਰਾ ਕੁਛ ਯੂਨੀਕ ਸੀਗਾ ਅਤੇ ਮੇਰਾ ਪਹਿਲਾ ਜਿਹੜਾ ਐਕਸਪੀਰੀਅੰਸ ਰਿਹਾ ਸੀ ਓਨਲਾਈਨ ਸ਼ੌਪਿੰਗ ਦਾ ਉਹ ਬਹੁਤ ਹੀ ਵਧੀਆ ਰਿਹਾ ਸੀ